ਫਤਿਹਗੜ੍ਹ ਸਾਹਿਬ ਵਿੱਚ ਗਰਮੀ ਸਰਦੀ ਬਸੰਤ ਪਤਝੜ ਬਰਸਾਤ ਹਰ ਤਰ੍ਹਾਂ ਦਾ ਮੌਸਮ ਇੱਥੇ ਪਾਇਆ ਜਾਂਦਾ ਜਿਵੇਂ ਕਿ ਸਰਦੀਆਂ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਮੋਸਟਲੀ ਸਬਜ਼ੀਆਂ ਨੇ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਰੀਆਂ ਸਬਜ਼ੀਆਂ ਤਾਜ਼ੀਆਂ ਸਬਜ਼ੀਆਂ ਜਿਹਦੇ ਵਿੱਚ ਗੋਭੀ ਗਾਜਰਾਂ ਮੂਲੀ ਸਲਗਮ ਸਾਗ ਪਾਲਕ ਮੇਥੇ ਇਹ ਸਾਰੀਆਂ ਚੀਜ਼ਾਂ ਸਾਡੀ ਬੋਡੀ ਨੂੰ ਜਿਹੜੀ ਗਰਮੀ ਦਿੰਦੀਆਂ ਰਹਿੰਦੀਆਂ ਨੇ ਅਤੇ ਸਾਨੂੰ ਇਨ੍ਹਾਂ ਦਾ ਸੇਵਨ ਕਰਦੇ ਕਰਦੇ ਰਹਿਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਅਤੇ ਇਸ ਸੀਜ ਮੌ ਮੌਸਮ ਦੇ ਵਿੱਚ ਸਾਡੇ ਕੱਪੜੇ ਨੇ ਜਿਹੜੇ ਉਹ ਗਰਮ ਅਸੀਂ ਪਾਉਦੇ ਹਾਂ ਅਤੇ ਪੀਣ ਦੇ ਲਈ ਵੀ ਅਸੀਂ ਜ਼ਿਆਦਾਤਰ ਹੋਟ ਚ ਗਰਮ ਚੀਜ਼ਾਂ ਯੂਜ ਕਰਦੇ ਹਾਂ ਅਤੇ ਇੱਦਾਂ ਹੀ ਗਰਮੀਆਂ ਦੇ ਵਿੱਚ ਨੇ ਜਿਹੜੀਆਂ ਗਰਮੀਆਂ ਦੇ ਵਿੱਚ ਸਬਜ਼ੀਆਂ ਨੇ ਜਿਹੜੀਆਂ ਉਹ ਹਰੀਆਂ ਸਬਜ਼ੀਆਂ ਉਹ ਘੱਟ ਜਾਂਦੀਆਂ ਨੇ ਅਤੇ ਦੂਜੀਆਂ ਦਾਲਾਂ ਵਗੈਰਾ ਜਿਵੇਂ ਖਿਚੜੀ ਹੋ ਗਈ ਧੋਵੀਂ ਮੂੰਗੀ ਦਾਲ ਹੋ ਗਈ ਇਹ ਚੀਜ਼ਾਂ ਅਸੀਂ ਜ਼ਿਆਦਾ ਵਰਤੋਂ ਕਰਦੇ ਹਾਂ ਅਤੇ ਪੱਤਝੜ ਦੇ ਵਿੱਚ ਜਿੱਦਾਂ ਮੋ ਪੱਤੇ ਨੇ ਜਿਹੜੇ ਸਾਰੇ ਦਰੱਖਤਾਂ ਦੇ ਝੜਨੇ ਸ਼ੁਰੂ ਹੋ ਜਾਂਦੇ ਨੇ ਉਸ ਟਾਈਮ ਨਾ ਤਾਂ ਜ਼ਿਆਦਾ ਗਰਮੀ ਰਹਿੰਦੀ ਹੈ ਨਾ ਹੀ ਜ਼ਿਆਦਾ ਸਰਦੀ ਆਉਂਦੀ ਆ ਐਵੇਂ ਹੀ ਬਸੰਤ ਹੁੰਦੀ ਆ ਬਸੰਤ ਦੇ ਵਿੱਚ ਬੱਚੇ ਜ਼ਿਆਦਾਤਰ ਪਤੰਗ ਉਡਾਉਂਦੇ ਨੇ ਨਵੇਂ ਪੱਤੇ ਉੱਗਣੇ ਸ਼ੁਰੂ ਹੋ ਜਾਂਦੇ ਨੇ ਅਤੇ ਇਸ ਟਾਈਮ ਬਹੁਤ ਸੋਹਣਾ ਮੌਸਮ ਹੁੰਦਾ ਨਾ ਤਾਂ ਇੱਥੇ ਗਰਮੀ ਹੁੰਦੀ ਆ ਨਾ ਹੀ ਸਰਦੀ ਹੁੰਦੀ ਆ ਅਤੇ ਇੱਦਾਂ ਹੀ ਬਰਸਾਤ ਦਾ ਮੌਸਮ ਆ ਜਿਹੜਾ ਬਰਸਾਤ ਦਾ ਮੌਸਮ ਆ ਉਹਦੇ ਵਿੱਚ ਨਾ ਲ ਕੰਟੀਨਿਊਸ ਹੀ ਲਗਾਤਾਰ ਹੀ ਕਿੰਨੇ ਦਿਨ ਮੀਂਹ ਪੈਂਦਾ ਰਹਿੰਦਾ ਅਤੇ ਉਹ ਮੀਂਹ ਪੈਣ ਕਰਕੇ ਜਿੱਦਾਂ ਸਾਡੇ ਆਮ ਘਰਾਂ ਦੇ ਵਿੱਚ ਗੰਡੋਏ ਵੀ ਹੋ ਜਾਂਦੇ ਨੇ ਖਾਣ ਪੀਣ ਦੇ ਸਮਾਨ ਨੂੰ ਉੱਲੀ ਲੱਗ ਜਾਂਦੀ ਆ ਹੈ ਨਾ ਅਤੇ ਉਸ ਜਿਹੜਾ ਬਰਸਾਤ ਦਾ ਮੌਸਮ ਆ ਜਿਹੜਾ ਬਹੁਤਾ ਵਧੀਆ ਨਹੀਂ ਮੰਨਿਆ ਜਾਂਦਾ ਕਿਉਂਕਿ ਉਹਦੇ ਵਿੱਚ ਲੋਕਾਂ ਦੇ ਆਮ ਕੰਮ ਕਾਰਾਂ ਦੇ ਵਿੱਚ ਵਿਘਨ ਪੈਂਦੀ ਆ ਅਤੇ ਬੱਚਿਆਂ ਨੂੰ ਸਕੂਲ ਜਾਣਾ ਔਖਾ ਹੋ ਜਾਂਦਾ ਇਸ ਕਰਕੇ ਬਰਸਾਤ ਦਾ ਮੌਸਮ ਆ ਜਿਹੜਾ ਉਹ ਠੀਕ ਠੀਕ ਹੀ ਮੰਨਿਆ ਜਾਂਦਾ